ਪੀ ਟੀ ਊਸ਼ਾ ਪੀ ਟੀ ਊਸ਼ਾ ਭਾਰਤੀ ਖਿਡਾਰੀਆਂ ਦੇ ਵਿੱਚ ਇੱਕ ਬਹੁਤ ਹੀ ਵਧੀਆ ਖਿਡਾਰਨ ਹੈ ਜਿਹੜੀ ਕਿ ਇੱਕ ਐਥਲੀਟ ਹੈ ਜਿਸਨੂੰ ਸਰਬ ਸ੍ਰੇਸ਼ਟ ਖਿਡਾਰਨ ਦੇ ਤੌਰ 'ਤੇ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸ ਨੂੰ ਉਡਣ ਪਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੀ ਟੀ ਊਸ਼ਾ ਨੇ ਖੇਡ ਦੇ ਮੈਦਾਨ ਵਿੱਚ ਬਹੁਤ ਸਾਰੇ ਮੈਡਲ ਜਿੱਤੇ ਹਨ ਅਤੇ ਅੰਤਰਰਾਸ਼ਟਰੀ ਖੇਡ ਸਭਾ ਦੌਰਾਨ ਉਹਨਾਂ ਦੁਆਰਾ ਇੱਕ ਸੌ ਇੱਕ ਮੈਡਲ ਵੀ ਹਾਸਲ ਕੀਤੇ ਗਏ ਹਨ ਪੀ ਟੀ ਊਸ਼ਾ ਅੱਜ ਦੇ ਜ਼ਮਾਨੇ ਲਈ ਅੱਜ ਦੀਆਂ ਔਰਤਾਂ ਲਈ ਇੱਕ ਬਹੁਤ ਵਧੀਆ ਪ੍ਰੇਰਣਾ ਹੈ ਜਿਹਨਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਸੇ ਵੀ ਮੁਸ ਮੁਸੀਬਤ ਵੇਲੇ ਹਾਰ ਨਹੀਂ ਮੰਨਣੀ ਚਾਹੀਦੀ ਸਗੋਂ ਹਿੰਮਤ ਰੱਖ ਕੇ ਸਾਨੂੰ ਜਿਹੜਾ ਕਿ ਉਸ ਮੁਸੀਬਤ ਦਾ ਸਾਹਮਣਾ ਕਰਨਾ ਚਾਹੀਦਾ ਹੈ ਪੀ ਟੀ ਊਸ਼ਾ ਦੁਆਰਾ ਬਹੁਤ ਹੀ ਵਧੀਆ ਅਤੇ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ ਹੈ ਅੰਤਰਰਾਸ਼ਟਰੀ ਖੇਡਾਂ ਵਿੱਚ ਇਹਨਾਂ ਦਾ ਜਨਮ ਕੇਰਲਾ ਵਿੱਚ ਹੋਇਆ ਹੈ ਅਤੇ ਇਹਨਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਸ ਸਮੇਂ ਔਰਤਾਂ ਨੂੰ ਘਰਾਂ ਦੇ ਤੋਂ ਬਾਹਰ ਨਿਕਲਣ ਦੀ ਜਿਹੜੀ ਪਾਬੰਦੀ ਲਗਾਈ ਗਈ ਸੀ ਪਰ ਪੀ ਟੀ ਊਸ਼ਾ ਜੀ ਨੇ ਹਾਰ ਨਹੀਂ ਮੰਨੀ ਅਤੇ ਇੱਕ ਬਿਹਤਰੀਨ ਖਿਲਾੜੀ ਤੌਰ 'ਤੇ ਆਪਣੀ ਇੱਕ ਪਹਿਚਾਣ ਬਣਾਈ ਜੋ ਕਿ ਇਹ ਹੀ ਸਿੱਖਿਆ ਦਿੰਦਾ ਹੈ ਕਿ ਸਮਾਂ ਜਿੱਦਾਂ ਦਾ ਵੀ ਹੋ ਕੋਈ ਵੀ ਹਾਲਾਤ ਹੋ ਤੁਹਾਨੂੰ ਆਪਣੇ 'ਤੇ ਇੱਕ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਤੇ ਖੁਦ ਨਾਲ ਇੱਕ ਵਾਅਦਾ ਕਰਨਾ ਚਾਹੀਦਾ ਕਿ ਅਸੀਂ ਇਸ ਕੰਮ ਨੂੰ ਪੂਰੀ ਤਰ੍ਹਾਂ ਕਰਾਂਗੇ ਅਤੇ ਸਫਲ ਹੋਵਾਂਗੇ ਅਤੇ ਉਸ ਵਿਸ਼ਵਾਸ ਨੂੰ ਦੇ ਰਾਹੀਂ ਆਪਣੇ ਇਸ ਵਚਨ ਨੂੰ ਕਦੇ ਵਾਅਦੇ ਨੂੰ ਭੁੱਲਣਾ ਨਹੀਂ ਹੈ ਅਤੇ ਇੱਕ ਬਿਹਤਰੀਨ ਜ਼ਿੰਦਗੀ ਜਿਹੜੀ ਹੈ ਤੁਸੀਂ ਆਪਣੇ ਅੰਤਿਮ ਸਮੇਂ ਵਿੱਚ ਜਿਹੜੀ ਹੈ ਹਾਸਿਲ ਕਰਨੀ ਹੈ ਪੀ ਟੀ ਊਸ਼ਾ ਨੇ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਅਤੇ ਪੀ ਟੀ ਊਸ਼ਾ ਜ਼ਿਆਦਾਤਰ ਸੌ ਮੀਟਰ ਅਤੇ ਦੋ ਸੌ ਮੀਟਰ ਦੌੜ ਵਿੱਚ ਮਾਹਿਰ ਸੀ ਅਤੇ ਉਹਨਾਂ ਨੇ ਆਪਣੇ ਹੀ ਜਿਹੜੇ ਹੈ ਰਿਕਾਰਡ ਬਣਾਏ ਹਨ ਅਤੇ ਪੀ ਟੀ ਊਸ਼ਾ ਦੁਆਰਾ ਚਾਰ ਸੋਨੇ ਦੇ ਤਗਮੇ ਉੱਨੀ ਸੌ ਛਿਆਸੀ ਵਿੱਚ ਜਿੱਤੇ ਗਏ ਹਨ ਪੀ ਟੀ ਊਸ਼ਾ ਨੂੰ ਭਾਰਤ ਸਰਕਾਰ ਦੁਆਰਾ ਪਦਮ ਭੂਸ਼ਣ ਦੁਆਰਾ ਵੀ ਸਨਮਾਨਿਤ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਸਰਕਾਰ ਵੱਲੋਂ ਜਿਹੜੀ ਹੈ ਕਿ ਰੇਲਵੇ ਦੀ ਜੋਬ ਵੀ ਆਫਰ ਕੀਤੀ ਗਈ ਹੈ ਇਸ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਹੈ ਆਪਣੇ 'ਤੇ ਇੱਕ ਵਿਸ਼ਵਾਸ ਰੱਖ ਕੇ ਸਾਨੂੰ ਆਪਣੀ ਲਾਈਫ ਦਾ ਇੱਕ ਟੀਚਾ ਰੱਖ ਕੇ ਉਸ 'ਤੇ ਫੋਕਸ ਕਰਨਾ ਚਾਹੀਦਾ ਹੈ ਅਤੇ ਹਾਲਾਤ ਜਿੱਦਾਂ ਦੇ ਵੀ ਹੋਣ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ